ਕੀ ਤੁਸੀਂ ਕਨੇਡੀਅਨ ਪੀਜ਼ਾ ਤੋਂ ਬੋਲ ਰਹੇ ਹੋ ਮੈਂ ਇੱਕ ਪੀਜ਼ਾ ਔਡਰ ਕੀਤਾ ਸੀਗਾ ਅਤੇ ਜਿਹੜਾ ਪੀਜ਼ਾ ਸੀ ਤੁਹਾਡਾ ਮੈਨੂੰ ਉਹ ਪਸੰਦ ਨਹੀਂ ਆਇਆ ਕਿਉਂਕਿ ਉਸ ਵਿੱਚ ਜੋ ਮੈਂ ਫਲੇਵਰ ਭਾਲਦਾ ਸੀ ਨਾ ਉਹ ਮਿਲਿਆ ਨਾ ਉਹ ਟੇਸਟ ਮਿਲਿਆ ਅਤੇ ਉਹ ਜਿਹੜਾ ਸੀਗਾ ਪੀਜ਼ਾ ਤੁਹਾਡਾ ਉਹ ਨਿਯਮਿਤ ਸ ਟਾਇਮ ਤੋਂ ਵੀ ਬਹੁਤ ਲੇਟ ਪ ਪਹੁੰਚਿਆ ਸਾਡੇ ਕੋਲ ਅਤੇ ਹੁਣ ਮੈਂ ਦੇਖਿਆ ਉਹਦੇ ਵਿੱਚ ਉਹ ਗੁਣਵੱਤਾ ਜੋ ਮੈਂ ਕਹਿੰਦਾ ਸੀ ਉਹ ਨਹੀਂ ਹੈ ਅਤੇ ਇਹ ਮੈਂ ਹੁਣ ਤੁਹਾਡੀ ਇਸ ਪੀਜੇ ਵਾਲੇ ਉਹ ਤੋਂ ਸੰਤੁਸ਼ਟ ਨਹੀਂ ਔਡਰ ਤੋਂ ਇਸ ਲਈ ਤੁਸੀਂ ਮੈਨੂੰ ਦੱਸੋ ਮੈਂ ਹੁਣੇ ਵਾਪਸ ਕਰਨਾ ਚਾਹੁੰਦਾ ਹੈ ਅਤੇ ਇਹਦੇ ਵਿੱਚ ਰਿਫੰਡ ਦੀ ਕੀ ਪੋਲਿਸੀ ਹੈ ਮੈਂ ਆਪਣੀ ਜਿਹੜੀ ਰਕਮ ਹੈ ਉਹ ਰਿਫੰਡ ਕਰਵਾਉਣਾ ਚਾਹੁੰਦਾ ਹੈ ਇਸ ਲਈ ਤੁਸੀਂ ਮੈਨੂੰ ਆਪਣਾ ਜੋ ਵੀ ਕੰਟੈਕਟ ਨੰਬਰ ਹੈ ਜਾਂ ਇਹਨੂੰ ਰਿਫੰਡ ਕਰਨ ਦੀ ਪੋਲਸੀ ਆ ਉਹਦੇ ਬਾਰੇ ਮੈਨੂੰ ਚੰਗੀ ਤਰ੍ਹਾਂ ਜਾਣਕਾਰੀ ਦਓ ਅਤੇ ਅੱਗੇ ਨੂੰ ਜੋ ਅਸੀਂ ਔਡਰ ਕਰਦੇ ਹਾਂ ਉਹਦਾ ਧਿਆਨ ਰੱਖਿਆ ਜਾਵੇ ਅਤੇ ਆਪਣੀ ਜਿਹੜੀ ਤੁਹਾਡੀ ਨੀਤੀ ਆ ਇਹ ਮੈਨੂੰ ਬਿਲਕੁਲ ਪਸੰਦ ਨਹੀਂ ਆਈ ਇਹਨੂੰ ਸਹੀ ਕੀਤਾ ਜਾਵੇ ਅਤੇ ਜਿਹੜਾ ਪੀਜ਼ਾ ਤੁਹਾਡਾ ਨਹੀਂ ਹੋਰ ਤੁਹਾਡੀ ਕੁਆਲਿਟੀ ਡਾਊਨ ਹੋ ਸਕਦੀ ਹੈ ਇਸ ਨਾਲ ਅਤੇ ਤੁਹਾਡੀ ਮਾਰਕੀਟ ਵੀ ਖਰਾਬ ਹੋ ਸਕਦੀ ਹੈ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖੋ ਅਤੇ ਜਿਹੜਾ ਆਪਣਾ ਔਡਰ ਆ ਸਮੇਂ ਸਿਰ ਭੇਜੋ ਧੰਨਵਾਦ ਜੀ